ਹਾਂਜੀ ਉਦਾਂ ਆਪਾਂ ਮੰਨਦੇ ਹਾਂ ਕਿ ਪਾਣੀ ਦੀ ਕਮੀ ਅੱਜ ਕੱਲ੍ਹ ਪੰਜਾਬ 'ਚ ਹੁੰਦੀ ਹੈ ਕਿਉਂਕਿ ਆਪਣੇ ਜਿਹੜੇ ਪੰਜਾਬੀ ਆ ਉਹ ਬਹੁਤ ਹੀ ਜ਼ਿਆਦਾ ਪਾਣੀ ਵੇਸਟ ਕਰਦੇ ਆ ਜ਼ਿਆਦਾਤਰ ਆਹ ਕਿਹੜਾ ਭਈਆ ਵਾਦ ਆ ਉਹ ਵੀ ਪਾਣੀ ਬਹੁਤ ਵੇਸਟ ਕਰਦਾ ਵਾ ਆਪਾਂ ਨੂੰ ਪਾਣੀ ਮਤਲਬ ਰੱਖਣਾ ਚਾਹੀਦਾ ਵਾ ਆਪਾਂ ਜਿੱਦਾਂ ਇੱਕ ਕਹਾਵਤੀ ਗੱਲ ਹੈ ਲਾਈਫ ਇਜ ਵਾਟਰ ਵਾਟਰ ਇਜ ਲਾਈਫ ਤਾਂ ਕਰਕੇ ਆਪਾਂ ਨੂੰ ਪਾਣੀ ਦੀ ਦੇਖਭਾਲ ਕਰਨੀ ਚਾਹੀਦੀ ਆ ਅੱਜ ਕੱਲ੍ਹ ਲੋਕ ਜਿਹੜੇ ਝੋਨਾ ਲਾਉਣੋ ਵੀ ਹਟ ਗਏ ਕਿਉਂਕਿ ਪੰਜਾਬ 'ਚ ਪਾਣੀ ਦਾ ਲੈਵਲ ਬਹੁਤ ਹੀ ਡਾਊਨ ਹੋ ਗਿਆ ਵਾ ਆਪਣੇ ਜਿਹੜੇ ਪੰਜਾਬੀ ਆ ਉਹ ਪਾਣੀ ਖੁੱਲ੍ਹੇ ਮਤਲਬ ਹਰ ਚੀਜ਼ ਵੱਲੋਂ ਖੁੱਲ੍ਹੇ ਆ ਜ਼ਿਆਦਾਤਰ ਉਹ ਪਾਣੀ ਵੀ ਬੜਾ ਉਹਨਾਂ ਨੇ ਨਹਾਉਣਾ ਹੁੰਦਾ ਤਾਂ ਬਹੁਤ ਪਾਣੀ ਵੇਸਟ ਕਰਦੇ ਆ ਸਾਰੇ ਵੱਲੋਂ ਆਪਾਂ ਪਾਣੀ ਕੀਮਤੀ ਆ ਕਿਉਂਕਿ ਆਉਂਦੇ ਦੋ ਹਜ਼ਾਰ ਪੰਜਾਹ ਇੱਕ ਸਰਚ ਦੇ ਅਨੁਸਾਰ ਦੋ ਹਜ਼ਾਰ ਪੰਜਾਹ 'ਚ ਪਾਣੀ ਮੁੱਕ ਜਾਣਾ ਸਾਰਾ ਅਤੇ ਆਪਾਂ ਕਹਿੰਦੇ ਹਾਂ ਕਿ ਆਪਣਾ ਕਿਹੜਾ ਹੋ ਸਕੇ ਅਤੇ ਕਿੰਨਾ ਆਪਾਂ ਪਾਣੀ ਬਚਾਈਏ ਅਤੇ ਉੱਨਾ ਵਧੀਆ ਵਾ ਆਪਣੇ ਜਿਹੜੇ ਪਾਣੀ ਨੂੰ ਲੈ ਕੇ ਅਤੇ ਆਪਣੇ ਗੌਰਮੈਂਟ ਨੇ ਇੱਕ ਦੀਨ ਵੀ ਚਲਾਈ ਹੁਣ ਜਿੱਦਾਂ ਆਪਾਂ ਮਹਾਰਾਸ਼ਟਰ ਦਿੱਲੀ 'ਚ ਜਾਈਏ ਉੱਥੇ ਪੰਜ ਰੁਪਏ ਦਾ ਪੈਕਟ ਮਿਲਦਾ ਪਾਣੀ ਦਾ ਅਤੇ ਆਪਣੇ ਇੱਥੇ ਪਾਣੀ ਬਹੁਤ ਹੀ ਜ਼ਿਆਦਾ ਹੱਦ ਤੋਂ ਵੱਧ ਜ਼ਿਆਦਾ ਵਾ ਅਤੇ ਆਪਾਂ ਵੱਧ ਤੋਂ ਵੱਧ ਪਾਣੀ ਕਹੀਏ ਤਾਂ ਪਾਣੀ ਨੂੰ ਸਾਂਭਣਾ ਚਾਹੀਦਾ ਵਾ ਅਤੇ ਆਪਾਂ ਨੂੰ ਜਿਹੜਾ ਬਾਰਿਸ਼ੀ ਪਾਣੀ ਹੁੰਦਾ ਵਾ ਜਿਦਾਂ ਸੌਣ ਦੇ ਮਹੀਨੇ ਮੀਂਹ ਪੈਂਦੇ ਕਈ ਲੋਕ ਏਡੇ ਇੰਨੇ ਸਮਾਰਟ ਹੁੰਦੇ ਆ ਕਿ ਉਹਨਾਂ ਨੇ ਬਾਰਿਸ਼ ਦਾ ਪਾਣੀ ਰੱਖਿਆ ਹੁੰਦਾ ਵਾ ਥੈਂਕ ਯੂ ਵਾਟਰ ਇਜ਼